ਭੰਗੜਾ ਪੰਜਾਬ ਦਾ ਲੋਕ ਨਾਚ ਹੈ ਇਹ ਲੋਕਾਂ ਦਾ ਪ੍ਰਿਆ ਨਾਚ ਵੀ ਹੈ ਇਸ ਨੂੰ ਛੋਟੇ ਤੋਂ ਲੈ ਕੇ ਵੱਡੇ ਹਰ ਪ੍ਰੋਗਰਾਮ ਵਿੱਚ ਕੀਤਾ ਜਾਂਦਾ ਹੈ ਭੰਗੜਾ ਐਰੋਬਿਕਸ ਉਸ ਇਨਸਾਨ ਲਈ ਬਹੁਤ ਹੀ ਵਧੀਆ ਮੰਨਿਆ ਗਿਆ ਹੈ ਜੋ ਕਿ ਮੋਟਾਪੇ ਦਾ ਸ਼ਿਕਾਰ ਹੈ ਭੰਗੜਾ ਐਰੋਬਿਕਸ ਕਰਨ ਨਾਲ ਸਾਡਾ ਮੋਟਾਪਾ ਘਟਦਾ ਹੈ ਸਾਡਾ ਵਜ਼ਨ ਘਟਦਾ ਹੈ ਸਾਡੇ ਢਿੱਡ ਦੀ ਚਰਬੀ ਅਤੇ ਬਾਹਾਂ ਦੀ ਚਰਬੀ ਘਟਦੀ ਹੈ ਇਸ ਨਾਲ ਸਾਡੀ ਸਿਹਤ ਤੰਦਰੁਸਤ ਹੁੰਦੀ ਹੈ ਸਾਡੀ ਸਰੀਰਕ ਸਿਹਤ ਦੇ ਨਾਲ ਨਾਲ ਮਾਨਸਿਕ ਸਿਹਤ ਵੀ ਤੰਦਰੁਸਤ ਹੁੰਦੀ ਹੈ ਇਹ ਜਿਹਾ ਕਿੱਸਾ ਮੇਰੇ ਨਾਲ ਉਦੋਂ ਵਾਪਰਿਆ ਜਦੋਂ ਕੋਵਿਡ ਦਾ ਟਾਈਮ ਸੀ ਕੋਵਿਡ ਦੌਰਾਨ ਘਰ ਬਹਿ ਬਹਿ ਕਿ ਮੇਰਾ ਮੋਟਾਪਾ ਵੱਧ ਗਿਆ ਮੈਂ ਮੋਟਾਪੇ ਦਾ ਸ਼ਿਕਾਰ ਹੋ ਗਈ ਜਿਸ ਕਾਰਨ ਮੇਰੇ ਤੋਂ ਕੰਮ ਨਹੀਂ ਕੀਤਾ ਜਾਂਦਾ ਸੀ ਮੇਰਾ ਸਾਹ ਫੁੱਲ ਜਾਂਦਾ ਸੀ ਮੇਰੇ ਤੋਂ ਭੱਜਿਆ ਨਹੀਂ ਜਾਂਦਾ ਸੀ ਮੈਨੂੰ ਕੰਮ ਕਰਨ ਵਿੱਚ ਬਹੁਤ ਤਕਲੀਫ਼ ਹੁੰਦੀ ਸੀ ਫਿਰ ਇੱਕ ਦਿਨ ਮੈਂ ਯੂਟੀਊਬ 'ਤੇ ਵੇਖਿਆ ਤਾਂ ਮੇਰੇ ਕੋਲ ਦੋ ਆਪਸ਼ਨ ਸੀ ਜਾਂ ਤਾਂ ਯੋਗਾ ਜਾਂ ਭੰਗੜਾ ਐਰੋਬਿਕਸ ਤਾਂ ਮੈਂ ਭੰਗੜਾ ਐਰੋਬਿਕਸ ਚੂਸ ਕੀਤਾ ਕਿਉਂਕਿ ਮੈਨੂੰ ਪਹਿਲਾਂ ਤੋਂ ਹੀ ਡਾਂਸ ਦਾ ਬਹੁਤ ਸ਼ੌਂਕ ਸੀ ਅਤੇ ਇਸ ਲਈ ਮੈਂ ਭੰਗੜਾ ਐਰੋਬਿਕਸ ਲਿਆ ਭੰਗੜਾ ਐਰੋਬਿਕਸ ਕਰਨ ਨਾਲ ਮੇਰੇ ਮੋਟਾਪਾ ਤਾਂ ਘਟਿਆ ਹੀ ਅਤੇ ਨਾਲ ਹੀ ਜਿਹੜੀ ਕੋਵਿਡ ਦੌਰਾਨ ਘਰ ਰਹਿ ਰਹਿ ਕੇ ਬੋਰੀਅਤ ਜਿਹੀ ਹੋਈ ਪਈ ਸੀ ਉਹ ਵੀ ਦੂਰ ਹੋਣ ਲੱਗ ਪਈ ਅਤੇ ਇਸ ਦੇ ਨਾਲ ਨਾਲ ਹੌਲੀ ਹੌਲੀ ਮੈਂ ਮੈਂ ਬਿਲਕੁਲ ਸਵੱਸਥ ਹੋ ਗਈ ਅਤੇ ਮੇਰੀ ਜ਼ਿੰਦਗੀ ਜਿਹੜੀ ਬੋਰਿੰਗ ਹੋਈ ਪਈ ਸੀ ਉਹਦੇ ਵਿੱਚ ਇੱਕ ਨਵਾਂ ਉਤਸ਼ਾਹ ਅਤੇ ਨਵੀਂ ਉਮੰਗ ਆ ਗਈ ਇਸ ਲਈ ਭੰਗੜਾ ਐਰੋਬਿਕਸ ਨੂੰ ਮੈਂ ਬਹੁਤ ਹੀ ਚੰਗਾ ਮੰਨਦੀ ਹਾਂ ਇਸਨੇ ਮੇਰੀ ਜ਼ਿੰਦਗੀ ਵਿੱਚ ਇੱਕ ਨਵਾਂ ਉਹਸ਼ਾਹ ਲਿਆਇਆ ਇੱਕ ਨਵਾਂ ਜੋਸ਼ ਲਿਆ ਦਿੱਤਾ ਭੰਗੜਾ ਐਰੋਬਿਕਸ ਕਰਨ ਨਾਲ ਸਾਡੀ ਸਿਹਤ ਦਾ ਬਹੁਤ ਹੀ ਵਧੀਆ ਅਸਰ ਹੁੰਦਾ ਹੈ ਭੰਗੜਾ ਐਰੋਬਿਕਸ ਸਾਡੇ ਸਰੀਰ ਨੂੰ ਸਵੱਸਥ ਬਣਾਉਂਦਾ ਹੈ ਭੰਗੜਾ ਐਰੋਬਿਕਸ ਕਰਨ ਨਾਲ ਸਾਡੇ ਮਾਨਸਿਕ ਅਤੇ ਸਾਡੇ ਅੰਦਰ ਸਫੂਰਤੀ ਆਉਂਦੀ ਹੈ ਧੰਨਵਾਦ